ਮੈਨੂੰ ਬਚਪਨ ਤੋਂ ਹੀ ਦੌੜਣ ਦਾ ਬਹੁਤ ਸ਼ੌਕ ਸੀ ਮੈਂ ਸਕੂਲ ਅਤੇ ਕਾਲਜ ਵਿੱਚ ਜਦੋਂ ਵੀ ਕੋਈ ਫੰਕਸ਼ਨ ਪ੍ਰੋਗਰਾਮ ਹੁੰਦਾ ਸੀ ਮੈਂ ਦੌੜਾ ਵਿੱਚ ਭਾਗ ਜ਼ਰੂਰ ਲੈਂਦਾ ਹੁੰਦਾ ਸੀ ਮੈਂ ਆਪਣਾ ਮੈਨੂੰ ਦੌੜ ਬਹੁਤ ਹੀ ਪਸੰਦ ਹੈ ਮੈਂ ਆਹ ਸਾਡੇ ਸਾਡੇ ਲਾਗੇ ਜਦ ਵੀ ਦੌੜਾ ਹੁੰਦੀਆਂ ਹਨ ਮੈਂ ਉਹਨਾਂ ਵਿੱਚ ਹਿੱਸਾ ਲੈਂਦਾ ਹਾਂ ਮੈਂ ਰੋਜ਼ ਹੀ ਪੰਜ ਤੋਂ ਅੱਠ ਕਿਲੋਮੀਟਰ ਦੌੜ ਕਰਦਾ ਹਾਂ ਮੈਂ ਇੱਕ ਵਾਰ ਮੈਰਥਨ ਦੌੜਾਂ ਵਿੱਚ ਵੀ ਹਿੱਸਾ ਲਿਆ ਸੀ ਮੈਨੂੰ ਦੌੜ ਕੇ ਬਹੁਤ ਹੀ ਮਜ਼ਾ ਆਇਆ ਸੀ ਮੈਂ ਇਸ ਦੌੜ ਲਈ ਬਹੁਤ ਮਿਹਨਤ ਕੀਤੀ ਸੀ ਮੈਂ ਰੋਜ਼ ਹੀ ਕਈ ਕਈ ਕਿਲੋਮੀਟਰ ਤੱਕ ਦੌੜਦਾ ਹੁੰਦਾ ਸੀ ਮੈਨੂੰ ਇਸ ਵਿੱਚ ਬਹੁਤ ਹੀ ਆਨੰਦ ਆਉਂਦਾ ਸੀ ਦੌੜਣ ਨਾਲ ਸਾਡਾ ਸਰੀਰ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ ਇਹ ਸਾਡੇ ਸਰੀਰ ਦਾ ਇੱਕ ਅੰਗ ਬਣ ਚੁੱਕੇ ਹਨ ਦੌੜਨ ਨਾਲ ਇੱਕ ਤਾਂ ਸਰੀਰ ਦਿਮਾਗ ਤੰਦਰੁਸਤ ਚੁਸਤ ਰਹਿੰਦਾ ਹੈ